ਹੈਲੋ ਸਰ ਆਪਣੇ ਕੋਲ ਕੀ ਕਹਿੰਦੇ ਆ ਗੁਡ ਮੋਰਨਿੰਗ ਸਰ ਪਹਿਲਾਂ ਤਾਂ ਸਰ ਵਿਨੋਦ ਦੀ ਬੁੱਕ ਇਸ਼ੂ ਕਰਾਣੀ ਸੀਗੀ ਇੱਕ ਆਪਣੇ ਸੀਡੀਪੀ ਦੀ ਅਤੇ ਫਿਜੀਕਲ ਐਜੂਕੇਸ਼ਨ ਦੀ ਹੋ ਜਾਏਗੀ ਜੀ ਬਸ ਜੀ ਅਤੇ ਹੋਰ ਆਪਣੇ ਕੋਲ ਓਹ ਕੀ ਨਾਮ ਹੈ ਇੱਕ ਲੁਸੈਂਟ ਇਸ਼ੂ ਕਰਾਉਣੀ ਸੀਗੀ ਲੁਸੈਂਟ ਜੀਕੇ ਦੀ ਲੋਅਸੈਂਡ ਜੀ ਇੰਗਲਿਸ਼ ਮੀਡੀਅਮ ਨਹੀਂ ਨਹੀਂ ਜੀ ਨਹੀਂ ਜੀ ਜਾਂ ਲੂਅਸੈਂਟ ਹੋ ਜੇ ਜਾ ਹੋ ਜੇ ਤਰੁਣ ਗੋਇਲ ਜੀਕੇ ਦੀ ਕਰਾਣੀ ਸੀ ਅਤੇ ਸਰ ਉਹ ਕਿੰਨੇ ਕੁ ਦਿਨ ਵਾਸਤੇ ਇਸ਼ੂ ਕਰਾ ਕੇ ਲੈ ਕੇ ਗਿਆ ਅੱਛਾ ਨਹੀਂ ਹੁਣ ਕਦੋਂ ਵਾਪਸ ਕਦੋਂ ਦੇ ਕੇ ਜਾਏਗਾ ਬੁਕ ਤਿੰਨ ਦਿਨ ਬਾਅਦ ਦੇ ਕੇ ਜਾਏਗਾ ਅੱਛਾ ਅਤੇ ਸਰ ਉਹ ਜਦੋਂ ਦੇ ਜੇ ਨਾ ਉਹ ਕੀ ਕਹਿੰਦੇ ਉਦੋਂ ਮੈਨੂੰ ਕਾਲ ਕਰ ਲਿਆ ਜੇ ਅਤੇ ਮੈਨੂੰ ਦੱਸ ਦਿਆ ਜੇ ਵੀ ਆਗੀ ਬੁੱਕ ਅਤੇ ਇੱਕ ਤਰੁਣ ਗੋਇਲ ਮੈਂ ਇਸ਼ੂ ਕਰਾਉਣੀ ਸੀਗੀ ਓਦੋਂ ਪੜ੍ਹ ਲਵਾਂ ਨਾ ਬੁੱਕ ਅੱਛਾ ਇਕ ਉਹ ਉਹ ਦੇ ਦਿਆ ਜੇ ਵਿਨੋਦ ਦੀ ਇੱਕ ਸੀਡੀਪੀ ਅਤੇ ਫਿਜੀਕਲ ਐਜੂਕੇਸ਼ਨ ਦੇ ਦਿਆ ਜੀ ਵਿਨੋਦ ਦੀ ਜੀ ਹਾਂਜੀ ਹਾਂਜੀ ਸਰ ਅਤੇ ਕੀ ਕਹਿੰਦੇ ਆ ਸਰ ਮਤਲਬ ਜਿਵੇਂ ਆ ਇਸ਼ੂ ਕਿੰਨੇ ਦਿਨਾਂ ਬਾਅਦ ਮਤਲਬ ਵਾਪਸ ਕਰਨੀ ਪਏਗੀ ਮੈਨੂੰ ਬੁਕਸ ਇਹ ਸਾਰੀਆਂ ਜਿਹੜੀ ਮੈਂ ਇਸ਼ੂ ਕਰਾਉਣ ਜਾ ਰਿਹਾ ਅੱਛਾ ਚਲੋ ਸਰ ਐਂ ਕਰੋ ਫਿਰ ਆਹ ਕਰ ਦਿਓ ਇੱਕ ਵਾਰੀ ਇਸ਼ੂ ਆਪਣੇ ਕੀ ਕਹਿੰਦੇ ਤਰੁਣ ਗੋਇਲ ਕਰ ਦਿਓ ਸੀਡੀਪੀ ਕਰਦੋ ਅਤੇ ਫਿਜੀਕਲ ਐਜੂਕੇਸ਼ਨ ਕਰ ਦਿਓ ਵਿਨੋਦ ਦੀ ਅਤੇ ਸਰ ਮਤਲਬ ਦਸ ਦਿਨ ਤੋਂ ਜ਼ਿਆਦਾ ਨਹੀਂ ਟਾਈਮ ਹੋ ਸਕਦਾ ਮਤਲਬ ਕਿ ਦਸ ਦਿਨ ਅੱਛਾ ਕੋਈ ਨਹੀਂ ਸਰ ਵੇਖਣੇ ਆ ਵੈਸੇ ਗੇੜਾ ਮੇਰਾ ਲੱਗਣਾ ਹੀ ਅਗਲਾ ਗੇੜਾ ਵੀ ਲੱਗਣਾ ਮਤਲਬ ਤਿੰਨ ਦਿਨ ਬਾਅਦ ਜਿਵੇਂ ਤੁਸੀਂ ਦੱਸ ਤੁਸੀਂ ਦੱਸਿਆ ਵੀ ਉਹ ਵਾਪਸ ਕਰ ਜੇਗਾ ਲੂਸੈਂਟ ਦੀ ਬੁੱਕ ਅਤੇ ਤਿੰਨ ਦਿਨ ਬਾਅਦ ਵੀ ਗੇੜਾ ਲੱਗਣਾ ਹੀ ਐਂਈ ਕਰਨੇ ਫਿਰ ਇੱਕ ਵਾਰੀ ਮੈਂ ਆਹ ਤਿੰਨ ਬੁੱਕ ਈਸੂ ਕਰਾ ਲੈਂਦਾ ਆਪਣੇ ਵਿਨੋਦ ਦੀ ਸੀਡੀਪੀ ਅਤੇ ਆਪਣੇ ਹੋਰ ਕਿਹੜੀ ਸੀ ਫਿਜੀਕਲ ਐਜੂਕੇਸ਼ਨ ਅਤੇ ਇੱਕ ਆਹ ਤਰੁਨ ਗੋਇਲ ਜੀਕੇ ਦੀ ਆ ਤਿੰਨ ਬੁੱਕ ਕਰਾ ਲੈਂਦਾ ਅਤੇ ਬਾਕੀ ਤੁਸੀਂ ਦੱਸਿਆ ਜਿਵੇਂ ਲੂਸੈਂਟ ਆ ਹੀ ਜੇਗੀ ਪਰਸੋਂ ਚੌਥੇ ਉਦੋਂ ਮੈਂ ਉਹ ਕਰਾ ਲਾਂਗਾ ਠੀਕ ਆ ਸਰ ਆ ਕਰੋ ਫਿਰ ਅਤੇ ਸਾਈਨ ਕਿੱਥੇ ਕਰਨੇ ਉਹ ਦੱਸ ਦਿਓ ਜੀ ਓਕੇ ਸਰ ਆ ਕਰ ਓਕੇ ਸਰ ਹੈਂ ਜੀ